ਪੰਛੀ ਪੰਛੀਆਂ ਦੇ ਵਿੱਚ ਦੇਖਣ ਨੂੰ ਪੰਜਾਬ ਦੇ ਵਿੱਚ ਬਹੁਤ ਪੰਛੀਆਂ ਦੀਆਂ ਕਿਸਮਾਂ ਪਾਈਆਂ ਜਾਂਦੀਆਂ ਜਿਵੇਂ ਪੰਜਾਬ ਦਾ ਰਾਜ ਪੰਛੀ ਬਾਜ ਨੂੰ ਮੰਨਿਆ ਜਾਂਦਾ ਹੈ ਬਾਜ ਤੋਤੇ ਚਿੜੀਆਂ ਕਾਂ ਘੁੱਗੀਆਂ ਕਟਾਰਾਂ ਅਤੇ ਕਬੂਤਰ ਇਸ ਤੋਂ ਇਲਾਵਾ ਪੰਛੀਆਂ ਦੀਆਂ ਹੋਰ ਵੀ ਕਈ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ ਬਾਜ ਇੱਕ ਇਹੋ ਜਿਹਾ ਪੰਛੀ ਹੈ ਜੋ ਕਿ ਖੁਦ ਸ਼ਿਕਾਰ ਕਰਕੇ ਆਪਣਾ ਖਾਣਾ ਬਣਾਉਂਦਾ ਹੈ ਅਤੇ ਇਹ ਸਭ ਤੋਂ ਅਲੱਗ ਰਹਿਣਾ ਪਸੰਦ ਕਰਦਾ ਹੈ ਜ਼ਿਆਦਾਤਰ ਬਾਜ ਆਲ੍ਹਣਾ ਜਾਂ ਆਪਣਾ ਕੋਈ ਵੀ ਘਰ ਨਹੀਂ ਬਣਾਉਂਦਾ ਬਾਜ ਇੱਕ ਉੱਚੀ ਚੋਟੀ 'ਤੇ ਰਹਿਣਾ ਪਸੰਦ ਕਰਦਾ ਹੈ ਮੰਨਿਆ ਜਾਂਦਾ ਹੈ ਬਾਜ ਦੀ ਉਮਰ ਸੌ ਸਾਲ ਦੀ ਹੁੰਦੀ ਹੈ ਕਈ ਵਾਰ ਕਿ ਬਾਜ ਬੁੱਢਾ ਹੋਣ 'ਤੇ ਆਪਣੇ ਚੁੰਝ ਅਤੇ ਆਪਣੀਆਂ ਨਹੁੰਆਂ ਨੂੰ ਤੋੜ ਕੇ ਦੁਬਾਰਾ ਕਿਸੇ ਪਰਬਤ ਦੀ ਉੱਚੀ ਚੋਟੀ 'ਤੇ ਜਾ ਕੇ ਆਪਣੀ ਚੁੰਝ ਨੂੰ ਤੋੜਦਾ ਹੈ ਅਤੇ ਇੱਕ ਨਵਾਂ ਜੀਵਨ ਪ੍ਰਾਪਤ ਕਰਦਾ ਹੈ ਇਸ ਤੋਂ ਇਲਾਵਾ ਕਬੂਤਰਾਂ ਕਬੂਤਰ ਦੀ ਪੰਜਾਬ ਦੇ ਵਿੱਚ ਬਾਜ਼ੀਆਂ ਨੂੰ ਬਹੁਤ ਮਸ਼ਹੂਰ ਮੰਨਿਆ ਜਾਂਦਾ ਹੈ ਬਾਜ਼ੀਆਂ ਦੇ ਵਿੱਚ ਕੀ ਹੁੰਦਾ ਹੈ ਕਾਫੀ ਇਕੱਠੇ ਕਬੂਤਰਾਂ ਨੂੰ ਜੋਟੀਆਂ ਬਣਾ ਕੇ ਛੱਡਿਆ ਜਾਂਦਾ ਹੈ ਉਹਨਾਂ ਦੇ ਵਿੱਚੋਂ ਜਿਹੜਾ ਵੀ ਕਬੂਤਰ ਬਹੁਤ ਜ਼ਿਆਦਾ ਟਾਈਮ ਖੁੱਲ੍ਹੇ ਅਸਮਾਨ ਦੇ ਵਿੱਚ ਉੱਡਦਾ ਹੈ ਅਤੇ ਸਭ ਤੋਂ ਲੇਟ ਨੀਚੇ ਉੱਤਰਦਾ ਹੈ ਤਾਂ ਉਹ ਸਭ ਤੋਂ ਵੱਧ ਆਪਣਾ ਇਨਾਮ ਪ੍ਰਾਪਤ ਕਰਦਾ ਹੈ ਤਾਂ ਉਸਨੂੰ ਜੇਤੂ ਕਰਾਰ ਦਿੱਤਾ ਜਾਂਦਾ ਹੈ ਇਸ ਤੋਂ ਇਲਾਵਾ ਤੋਤੇ ਤੋਤੇ ਇੱਕ ਇਹੋ ਜਿਹੀ ਖਾਸ ਕਿਸਮ ਦੇ ਪੰਛੀ ਹਨ ਜੋ ਕਿ ਦੇਖਣ ਦੇ ਵਿੱਚ ਵੀ ਬਹੁਤ ਸੋਹਣੇ ਹੁੰਦੇ ਹਨ ਅਤੇ ਆਪਣਾ ਖਾਣ ਦੇ ਵਿੱਚ ਸਭ ਤੋਂ ਵੱਧ ਫਲਦਾਰ ਚੀਜ਼ਾਂ ਨੂੰ ਪਸੰਦ ਕਰਦੇ ਹਨ ਜ਼ਿਆਦਾਤਰ ਤੋਤੇ ਅਤੇ ਤੋਤਿਆਂ ਦੇ ਬੱਚੇ ਦਰੱਖਤਾਂ ਦੇ ਵਿੱਚ ਆਪਣੇ ਖੁੱਡੇ ਆਲ੍ਹਣੇ ਬਣਾ ਕੇ ਰਹਿੰਦੇ ਹਨ